ਸਤਿ ਸ਼੍ਰੀ ਅਕਾਲ ਜੀ ਪੰਜਾਬੀ ਭਾਸ਼ਾ ਵੀ ਭਾਰਤ ਦੀ ਇੱਕ ਮੁੱਖ ਭਾਸ਼ਾ ਹੈਗੀ ਜਿਹੜੀ ਵੱਡੇ ਸਤਰ 'ਤੇ ਵਰਤੀ ਜਾਂਦੀ ਹੈਗੀ ਜੀ ਅਤੇ ਪੰਜਾਬ ਦੇ ਵਿੱਚ ਹੀ ਆਹ ਮੁੱਖ ਰੂਪ ਤੋਂ ਬੋਲੀ ਜਾਂਦੀ ਹੈ ਅਤੇ ਬਾਹਰ ਜਿੰਨੇ ਵੀ ਪੰਜਾਬੀ ਲੋਕ ਰਹਿੰਦੇ ਆ ਪੰਜਾਬ ਦੇ ਲੋਕ ਰਹਿੰਦੇ ਆ ਉੱਥੇ ਇਹੀ ਭਾਸ਼ਾ ਉਹ ਆਪਸ 'ਚ ਬੋਲਦੇ ਹਨ ਅਤੇ ਦੂਜੀ ਚੀਜ਼ ਦੂਜੀ ਭਾਸ਼ਾਵਾਂ ਨਾਲ ਜੇ ਇਹਦੀ ਤੁਲਨਾ ਕੀਤੀ ਜਾਵੇ ਤਾਂ ਇਹੀ ਹੈ ਜੀ ਵੀ ਜਿਹੜੀ ਇੰਡੀਆ ਦੀ ਜਿੰਨੀਆਂ ਵੀ ਮੁੱਖ ਭਾਸ਼ਾਵਾਂ ਹੈ ਜਿਹੜੀ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਨੇ ਉਹਨਾਂ 'ਚ ਜਿਹੜੀ ਬਾਈ ਭਾਸ਼ਾ ਹੈ ਉਹਨਾਂ 'ਚ ਪੰਜਾਬੀ ਵੀ ਇੱਕ ਹੈਗੀ ਜਿਹੜੀ ਇੰਡੀਆ ਦੀ ਜਿਹੜੀ ਪੂਰੇ ਭਾਰਤ ਦੀ ਜਿਹੜੀ ਮੇਨ ਭਾਸ਼ਾਵਾਂ ਬਾਈ ਭਾਸ਼ਾਵਾਂ ਭਾਸ਼ਾ ਜਿਹੜੀ ਬਾਈ ਭਾਰਤ ਸਰਕਾਰ ਨੇ ਜਿਹੜੀ ਮੰਨੀ ਹੈ ਸੰਵਿਧਾਨ ਦੇ ਵਿੱਚ ਉਹਨਾਂ 'ਚ ਇੱਕ ਪੰਜਾਬੀ ਭਾਸ਼ਾ ਵੀ ਹੈ ਅਤੇ ਦੂਜੀਆਂ ਭਾਸ਼ਾਵਾਂ ਵਾਲੀ ਖੇਤਰੀ ਭਾਸ਼ਾ ਵੀ ਹੈ ਜੀ ਜਿਹੜੀ ਪੰਜਾਬ ਦੇ ਏਰੀਏ ਦੇ ਵਿੱਚ ਹੀ ਮੁੱਖ ਰੂਪ ਤੋਂ ਇਹ ਵਰਤੀ ਜਾਂਦੀ ਹੈ ਅਤੇ ਬਾਹਰ ਦਾ ਬੰਦਾ ਜੇ ਕੋਈ ਇੱਥੇ ਆਉਂਦਾ ਹੈ ਉਹਨੂੰ ਉਹ ਇਹ ਚੀਜ਼ ਹੈਗੀ ਵੀ ਜੇ ਪੰਜਾਬੀ ਦੀ ਉਹਨੂੰ ਨਹੀਂ ਸਮਝ ਹੈਗੀ ਅਤੇ ਵੀ ਇਹ ਇੰਨੀ ਔਖੀ ਹੈ ਨਹੀਂ ਹਿੰਦੀ ਦੇ ਨਾਲ ਥੋੜ੍ਹੀ ਥੋੜ੍ਹੀ ਇਹ ਇਹ ਮੈਚ ਕਰਦੀ ਹੈ ਅਤੇ ਬੰਦਾ ਗੱਲ ਨੂੰ ਸਮਝ ਲੈਂਦਾ ਹੁੰਦਾ ਹਾਂ ਪੜ੍ਹਨ 'ਚ ਬਿਲਕੁਲ ਉਹ ਬਿਲਕੁਲ ਉਹਨੂੰ ਆਊਗੀ ਪ੍ਰੋਬਲਮ ਲੇਕਿਨ ਉਹ ਸਮਝ ਸਕਦਾ ਕਿਉਂਕਿ ਜਿਵੇਂ ਪੰਜਾਬੀ ਗਾਣੇ ਹੈ ਜੀ ਪੰਜਾਬੀ ਗਾਣੇ ਤਾਂ ਬਾਹਲੇ ਮਤਲਬ ਚਲਦੇ ਹੈ ਅਤੇ ਸਾਰੇ ਲੋਕ ਉਹਨਾਂ ਨੂੰ ਸਮਝਦੇ ਵੀ ਆ ਸੁਣਦੇ ਵੀ ਆ ਧੰਨਵਾਦ